ਹਿੰਸਾ ਦਾ ਮੁੱਦਾ ਤਾਂ ਇਹ ਹੀ ਹੈ ਕੁਛ ਅਵਾਰਾ ਮੁੰਡੇ ਉੱਥੇ ਆ ਕੇ ਖਿਡਾਰੀਆਂ ਨੂੰ ਤੰਗ ਕਰਦੇ ਹਨ ਆਮ ਜਨਤਾ ਨੂੰ ਵੀ ਕਰਦੇ ਹਨ ਜਿਸ ਕਰਕੇ ਉੱਥੇ ਕਾਫ਼ੀ ਦਿੱਕਤ ਆਉਂਦੀ ਹੈ ਇਸ ਕਰਕੇ ਸਰਕਾਰ ਨੇ ਉੱਥੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਾਈ ਹੁੰਦੀ ਹੈ ਜਿਸ ਕਰਕੇ ਖਿਡਾਰੀਆਂ ਵਧੀਆ ਖੇਡਣ ਸਕਣ ਅਤੇ ਹੋਰ ਵੀ ਦੇਖਣ ਵਾਲੇ ਦਰਸ਼ਕ ਦੇਖ ਕੇ ਵਧੀਆ ਆਪਣੇ ਘਰ ਜਾ ਸਕਣ